ਚਿੱਤਰਕਾਰੀ ਕਰਦੇ ਸਮੇਂ ਸਾਨੂੰ ਬਹੁਤ ਹੀ ਆਪਣਾ ਦਿਮਾਗ ਸਹੀ ਢੰਗ ਨਾਲ ਲਗਾਉਣਾ ਚਾਹੀਦਾ ਹੈ ਪਰ ਸਾਨੂੰ ਕਰਦੇ ਹੋਏ ਸਭ ਤੋਂ ਪਹਿਲਾਂ ਆਪਣੇ ਜੋ ਵੀ ਕਲਰ ਵਗੈਰਾ ਹੈ ਉਹਨੂੰ ਸਹੀ ਇਸਤੇਮਾਲ ਕਰਨਾ ਚਾਹੀਦੇ ਹਨ ਜੇ ਤਾਂ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਤਾਂ ਆਪਾਂ ਬਹੁਤ ਵਧੀਆ ਪੇਂਟਿੰਗ ਕਰ ਸਕਦੇ ਹਾਂ ਚਿੱਤਰਕਾਰੀ ਕਰਦੇ ਸਮੇਂ ਸਾਨੂੰ ਕੁਛ ਵਧੀਆ ਜਿੱਦਾਂ ਬ੍ਰੈਂਡ ਹੁੰਦੇ ਨੇ ਤੋਂਬੋ ਵੈਕਮ ਪੈਂਟਲ ਐਡ ਕੈਸਸੋਨ ਸਟੇਡ ਮੈਂ ਅੱਜ ਤੱਕ ਬਹੁਤ ਸਾਰੇ ਪੇਂਟਿੰਗਾਂ ਕੀਤੀਆਂ ਹਨ ਇਸ ਦੀ ਚਿੱਤਰਕਾਰੀ ਇਸ ਦੀ ਵਰਤੋਂ ਦੇ ਨਾਲ ਇਸ ਬ੍ਰੈਂਡ ਦੀ ਵਰਤੋਂ ਦੇ ਨਾਲ ਮੈਂ ਬਹੁਤ ਸਾਰੀ ਚਿੱਤਰਕਾਰੀ ਕੀਤੀ ਹੈ ਜਿਹਦੇ ਕਰਕੇ ਅਸੀਂ ਬਹੁਤ ਖੁਸ਼ ਵੀ ਹੋਏ ਹਾਂ ਇਹ ਸਾਡੇ ਦਿਲ ਨੂੰ ਬਹੁਤ ਖੁਸ਼ ਰੱਖਦਾ ਹੈ ਜਿਸ ਕਰਕੇ ਅਸੀਂ ਬਹੁਤ ਚੰਗੇ ਇਨਸਾਨ ਆਪਣੇ ਆਪ ਨੂੰ ਰੱਖਦੇ ਹਾਂ ਕਿ ਸਾਨੂੰ ਇਹ ਚੀਜ਼ ਆਉਂਦੀ ਹੈ ਸਾਨੂੰ ਆਪਣੇ ਆਪ 'ਤੇ ਬਹੁਤ ਜ਼ਿਆਦਾ ਗਰੂਰ ਹੁੰਦਾ ਕਿ ਹਾਂ ਸਾਨੂੰ ਡਰਾਇੰਗ ਆਉਂਦੀ ਹੈ ਸਾਨੂੰ ਚਿੱਤਰਕਾਰੀ ਆਉਂਦੀ ਹੈ ਆਪਾਂ ਕਿਸੇ ਵੀ ਚਿੱਤਰਕਾਰੀ 'ਤੇ ਬਣਾ ਸਕਦੇ ਹਾਂ ਇਹ ਬਹੁਤ ਵਧੀਆ ਸਾਨੂੰ ਕਰ ਸਕਦੇ ਹਨ ਵਾਹ ਸਾਡੇ ਚਿੱਤਰਕਾਰੀ ਦੇ ਵਿੱਚ ਕਿੰਨੇ ਵਧੀਆ ਪੇਂਟਿੰਗ ਕਲਰਸ ਜੋ ਸਾਨੂੰ ਰੰਗੀਨ ਭਰ ਰੰਗੀਨ ਨਾਲ ਭਰ ਦਿੰਦੇ ਹਨ ਇਹ ਰੰਗ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਧਾ ਵਧੀਆ ਰੰਗ ਦਿੰਦੇ ਹਨ ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਅਤੇ ਸਾਨੂੰ ਬਹੁਤ ਵਧੀਆ ਕਰ ਵਧੀਆ ਰੰਗੀਨ ਪਲ ਦਿੰਦੇ ਹਨ